ਦੋ ਗਿਆਰਾਂ ਦੋ ਹਜ਼ਾਰ ਤਿੰਨ ਦਸ ਅ ਦਸ ਦੋ ਹਜ਼ਾਰ ਚੋ ਚੌਦਾ ਚਾਰ ਉੱਨੀ ਸੌ ਅਠਾਨਵੇਂ ਪੰਦਰਾਂ ਸੱਤ ਉੱਨੀ ਸੌ ਛਿਆਲੀ ਦਸ ਬਾਰਾਂ ਉੱਨੀ ਸੌ ਬਹੱਤਰ